ਪੁਰਾਣੇ ਜ਼ਮਾਨੇ ਵਿੱਚ ਲੋਕਾਂ ਦੇ ਘਰ ਕੱਚੇ ਹੁੰਦੇ ਸਨ ਅਤੇ ਲੋਕਾਂ ਦੇ ਕੋਲ਼ ਐਨਾ ਪੈਸਾ ਨਹੀਂ ਹੁੰਦਾ ਸੀ ਕਿ ਉਹ ਆਪਣੇ ਘਰ ਨੂੰ ਟੈਲਾਂ ਲਗਾ ਸਕਣ ਜਾਂ ਫਰਸ਼ ਲਗਾ ਸਕਣ ਅਤੇ ਇਸਨੂੰ ਘਰ ਦੀ ਸਾਫ਼ ਸਫ਼ਾਈ ਤਾਂ ਫੇਰ ਵੀ ਕਰਨੀ ਜ਼ਰੂਰੀ ਸੀਗੀ ਜਿਹੜੀਆਂ ਔਰਤਾਂ ਸੀਗੀਆਂ ਉਹ ਆਪਣੇ ਘਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਾਫ਼ ਰੱਖਣ ਲਈ ਕਿ ਮਿੱਟੀ ਨਾ ਉੱਡੇ ਤਾਂ ਉਹ ਆਪਣੇ ਘਰ ਨੂੰ ਜਿਹੜੇ ਗੋਬਰ ਸੀਗਾ ਮਤਲਬ ਗੋਹਾ ਹੈ ਉਹਦੇ ਜਿਹੜੇ ਗਾ ਗ ਜਿਹਨੂੰ ਗਊ ਡੰਕ ਕਹਿੰਦੇ ਅਸੀਂ ਉਹਦੇ ਨਾਲ਼ ਲਿੱਪਦੀਆਂ ਸੀਗੀਆਂ ਇਹਦੇ ਵਿੱਚ ਸਾਡੀ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਨੇ ਸਭ ਤੋਂ ਪਹਿਲੀ ਗੱਲ ਹੈ ਇਹ ਜਿਹੜੀ ਹੈ ਪ੍ਰਕਿਰਤਿਕ ਹੈ ਇਹ ਜਿਹੜੇ ਹੈ ਰਸਾਇਣਿਕ ਖਾਦਾਂ ਤੋਂ ਵਗੈਰ ਬਣਿਆ ਹੁੰਦਾ ਹੈ ਭੌਤਿਕ ਅਵਸਥਾ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਕੁਦਰਤੀ ਇਹੀ ਔਰ ਇਹਦੇ ਵਿੱਚ ਜਿਹੜਾ ਹੈ ਇਹ ਸਭ ਤੋਂ ਵੱਡਾ ਲਾਭ ਇਹ ਹੈ ਕਿ ਜਿਹੜਾ ਕਮਰੇ ਨੂੰ ਠੰਡਾ ਰੱਖਦਾ ਹੈ ਗੋਹਾ ਹੈ ਜਿਹੜਾ ਉਹ ਕਮਰੇ ਨੂੰ ਇਹਦੇ ਨਾਲ਼ ਜਿਹੜੀ ਹੈ ਲਿਪਣੇ ਨਾਲ਼ ਮਿੱਟੀ ਹੁੰਦੀ ਹੈ ਅਤੇ ਵਿੱਚ ਗੋਹਾ ਰਲ਼ ਜਾਂਦਾ ਅਤੇ ਉਹਦੇ ਨਾਲ਼ ਕੀ ਹੁੰਦਾ ਹੈ ਕਮਰਾ ਠੰਡਾ ਰਹਿੰਦਾ ਹੈ